ਅੱਜ ਅਸੀਂ ਗੱਡੀ ਵਿੱਚ ਆਪਣੇ ਪਰਨਾ ਪਰਿਵਾਰ ਨਾਲ ਬਾਜ਼ਾਰ ਜਾਂਦੇ ਸੀ ਤਾਂ ਅਸੀਂ ਦੇਖਿਆ ਰਸਤੇ ਵਿੱਚ ਇੱਕ ਵਿਅਕਤੀ ਦਾ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਹੋਇਆ ਸੀ ਬੇਹੋਸ਼ ਹੋਇਆ ਸੀ ਗੱਡੀ ਵਿੱਚੋਂ ਉਤਰ ਕੇ ਅਸੀਂ ਉਸ ਦੀ ਹਾਲਤ ਦੇਖੀ ਅਤੇ ਉਸ ਨੂੰ ਸੜਕ ਤੋਂ ਇੱਕ ਸਾਈਡ ਕੀਤਾ ਅਤੇ ਉਸਨੂੰ ਪਾਣੀ ਪਿਆ ਜ਼ਿਆਦਾ ਸੱਟਾਂ ਹੋ ਜ਼ਿਆਦਾ ਅਤੇ ਉਸਨੂੰ ਮੁੱਢਲੀ ਸਹਾਇਤਾ ਦਿੱਤੀ ਜ਼ਿਆਦਾ ਗੰਭੀਰ ਸੱਟਾਂ ਹੋਣ ਕਰਕੇ ਅਸੀਂ ਜਲਦੀ ਤੋਂ ਜਲਦੀ ਐਬੂਲੈਂਸ ਨੂੰ ਫੋਨ ਕਰਿਆ ਐਬੂਲੈਂਸ ਨੂੰ ਫੋਨ ਕਰਿਆ ਉਸ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਅਤੇ ਡਾਕਟਰਾਂ ਦੁਆਰਾ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਅਤੇ ਲਾਕ ਡਾਕਟਰਾਂ ਦੁਆਰਾ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਅਤੇ ਅਤੇ ਉਸ ਦੇ ਪਰਿਵਾਰ ਨੂੰ ਸੰਪਰਕ ਕੀਤਾ ਗਿਆ ਕਿ ਉਹਨਾਂ ਦੇ ਵਿਅਕਤੀ ਦੀ ਐਕਸੀਡੈਂਟ ਹੋ ਗਿਆ ਜਲਦੀ ਤੋਂ ਜਲਦੀ ਉਹ ਹੋਸਪਿਟ ਹੋਸਪਿਟਲ ਵਿੱਚ ਆ ਸਕਣ ਅਤੇ ਉਸਦੇ ਪਰਿਵਾਰ ਨੂੰ ਸੰਪਰਕ ਕੀਤਾ ਗਿਆ ਉਸ ਨੂੰ ਮੁੱਢਲੀ ਸਹਾਇ ਸੰਪਰਕ ਕੀਤਾ ਗਿਆ ਅਤੇ ਡਾਕਟਰੀ ਕਾਰਜ 'ਚ ਕਾਰਜ ਕਾਰਵਾਈ ਪੂਰੀ ਕੀਤੀ ਗਈ ਡਾਕਟਰਾਂ ਦੁਆਰਾ ਉਸ ਵਿਅਕਤੀ ਦਾ ਇਲਾਜ ਸ਼ੁਰੂ ਕੀਤਾ ਗਿਆ ਅਤੇ ਇਲਾਜ ਸ਼ੁਰੂ ਕਰਨ ਤੋਂ ਬਾਅਦ ਡਾਕਟਰਾਂ ਨੇ ਬਾਹਰ ਆ ਕੇ ਦੱਸਿਆ ਕਿ ਉਸ ਵਿਅਕਤੀ ਦਾ ਉਸ ਵਿਅਕਤੀ ਖ਼ਤਰੇ ਤੋਂ ਬਾਹਰ ਹੈਗਾ ਇਸ ਤਰ੍ਹਾਂ ਅਸੀਂ ਉਸ ਵਿਅਕਤੀ ਦੀ ਜਾਨ ਬਚਾਈ ਅਤੇ ਉਸਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰਵਾਈ ਅਸੀਂ ਉਸ ਵਿਅਕਤੀ ਨੂੰ ਇੱਕ ਨਵਾਂ ਜੀਵਨ ਪ੍ਰਦਾਨ ਕੀਤਾ